ਹੈਲੋ ਭਾਅ ਜੀ ਮੈਂ ਮਨੀਸ਼ਾ ਬੋਲ ਰਹੀ ਹਾਂ ਮੈਂ ਰਾਤੀ ਤੁਹਾਡੇ ਕੋਲੋਂ ਇੱਕ ਕੈਬ ਬੁੱਕ ਕਰਵਾਈ ਸੀ ਨਾ ਹਾਂਜੀ ਹਾਂਜੀ ਅਤੇ ਉਹ ਦੇਖੋ ਕੈਬ ਦਾ ਜਿਹੜਾ ਤੁਸੀਂ ਨੰਬਰ ਦਿੱਤਾ ਡਰਾਈਵਰ ਦਾ ਨਾ ਡਰਾਈਵਰ ਫੋਨ ਚੁੱਕ ਰਿਹਾ ਨਾ ਉਹਨਾਂ ਦਾ ਫੋਨ ਦਾ ਕੋਈ ਰਿਪਲਾਈ ਆ ਰਿਹਾ ਤੁਸੀਂ ਦੇਖੋ ਨਾ ਭਾਅ ਜੀ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਮੈਂ ਦੇਖੋ ਇੱਥੋਂ ਦਿੱਲੀ ਜਾਣਾ ਦਿੱਲੀ ਤੋਂ ਅੱਗੇ ਮੇਰੇ ਬੇਟੇ ਦੀ ਕੈਨੇਡਾ ਦੀ ਫਲਾਈਟ ਹੈ ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਤੁਸੀਂ ਕੁਝ ਹੋਰ ਅਰੇਂਜਮੈਂਟ ਕਰ ਸਕਦੇ ਹੋ ਕਿ ਮੈਂ ਕੋਈ ਹੋਰ ਸਰਵਿਸਿਸ ਦੇਖਾਂ ਦੇਖੋ ਹਰ ਕਿਸੇ ਦੇ ਕੰਮ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਨਾ ਤੁਹਾਡੇ ਡਰਾਈਵਰ ਨੇ ਨਾ ਫੋਨ ਚੁੱਕਿਆ ਨਾ ਉਹ ਕਿਸੇ ਕਾਲ ਦਾ ਜਵਾਬ ਦੇ ਰਿਹਾ ਜਾਂ ਤਾਂ ਮੈਨੂੰ ਹੁਣ ਕੋਈ ਨਵੀਂ ਕੈਬ ਅਰੇਂਜ ਕਰਕੇ ਦਿਓ ਜਾਂ ਮੈਂ ਕੁਛ ਆਪਣਾ ਹੋਰ ਇੰਤਜ਼ਾਮ ਕਰਾਂ ਮੇਰਾ ਤਾਂ ਦੇਖੋ ਬਹੁਤ ਜ਼ਰੂਰੀ ਹੈ ਨਾ ਉੱਥੋਂ ਤੱਕ ਪਹੁੰਚਣਾ ਕਮ ਸੇ ਕਮ ਆਪਣੇ ਆਪ ਹੀ ਇਨਸਾਨ ਨੂੰ ਚਾਹੀਦਾ ਇੰਨੀ ਖੱਜਲ ਖਵਾਰੀ ਮੈਂ ਤਾਂ ਸੋਚਿਆ ਹੀ ਨਹੀਂ ਇਸ ਕਰਕੇ ਮੈਂ ਪਹਿਲਾਂ ਦੀ ਤੁਹਾਡੇ ਕੋਲ ਐਡਵਾਂਸ ਬੁਕਿੰਗ ਕਰਵਾਈ ਹੈ ਕਿ ਮੈਨੂੰ ਐਂਡ ਟਾਈਮ ਕੋਈ ਮੁਸ਼ਕਿਲ ਨਾ ਆਵੇ ਲੇਕਿਨ ਫਿਰ ਉਹੀ ਉਹੀ ਗੱਲ ਹੋਈ ਹੈ ਇਸ ਕਰਕੇ ਮੈਨੂੰ ਤਾਂ ਬੜੀ ਪਰੇਸ਼ਾਨੀ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੁਛ ਅਰੇਂਜ ਕਰਦੇ ਹੋ ਕਿ ਮੈਂ ਆਪਣਾ ਕੁਛ ਇੰਤਜ਼ਾਮ ਕਰਾਂ